ਹੈਲੋ ਭਾਅ ਜੀ ਉਬਰ ਕੰਪਨੀ ਤੋਂ ਬੋਲ ਰਹੇ ਹੋ ਭਾਅ ਜੀ ਅਸੀਂ ਨਾ ਕੈਬ ਬੁੱਕ ਕਰਨੀ ਸੀ ਠਾਠਗੜ੍ਹ ਤੋਂ ਚੰਡੀਗੜ੍ਹ ਜਾਣਾ ਵਾਂ ਫੈਮਲੀ ਮੈਂਬਰਸ ਆ ਦਸ ਕੁ ਆ ਨਾਲ ਫਰੈਂਡਸ ਵੀ ਹੋ ਜਾਣੇ ਆਂ ਘੁੰਮਣ ਫਿਰਣ ਵਾਸਤੇ ਅਸੀਂ ਜਾਣਾ ਵਾਂ ਅਸੀਂ ਸੋਚਿਆ ਕਿ ਸੋਲ੍ਹਾਂ ਮਾਰਚ ਨੂੰ ਅਸੀਂ ਜਾਵਾਂਗੇ ਸਮਾਂ ਸਾਢੇ ਕੁ ਨੌ ਵਜੇ ਦਾ ਸੋਚਿਆ ਭਾਅ ਜੀ ਕੈਬ ਬਾਰੇ ਦੱਸ ਦਿਓ ਤੁਹਾਡੇ ਕੋਲ ਵੱਡੀਆਂ ਵਾਂ ਜਾਂ ਛੋਟੀਆਂ ਵਾਂ ਚਾਹੀਦੀ ਤਾਂ ਸਾਨੂੰ ਵੱਡੀ ਆ ਕਿਉਂਕਿ ਸਾਡੇ ਫੈਮਲੀ ਮੈਂਬਰਸ ਵੀ ਆ ਅਤੇ ਨਾਲ ਫਰੈਂਡਸ ਵੀ ਆ ਅਤੇ ਕਿਰਾਇਆ ਵੀ ਦੱਸ ਦਿਓ ਕਿੰਨਾ ਵਾਂ ਕਿਰਾਇਆ ਇਸ ਕਰਕੇ ਪੁੱਛ ਰਹੇ ਹਾਂ ਕਿਉਂਕਿ ਸਾਨੂੰ ਇਹ ਵੀ ਦੱਸ ਦਿਓ ਕਿ ਤੁਹਾਡੇ ਡਰਾਈਵਰ ਦੇ ਹੱਥ ਭੇਜੀਏ ਜਾਂ ਤੁਸੀਂ ਔਨਲਾਈਨ ਪੇਮੈਂਟ ਕਰਨੀ ਆਂ ਡਰਾਈਵਰ ਜਿਹੜਾ ਵਾ ਉਹ ਨਸ਼ਾ ਵਗੈਰਾ ਨਾ ਕਰਦਾ ਹੋਵੇ ਕਿਉਂਕਿ ਸਮਾਂ ਜਿਹੜਾ ਵਾ ਉਹ ਜ਼ਿਆਦਾ ਲੱਗਣਾ ਪਹੁੰਚਣ 'ਤੇ ਪਿੰਡ ਤੋਂ ਜਾਣਾ ਅਸੀਂ ਬਾਕੀ ਭਾਅ ਜੀ ਇਹ ਆ ਕਿ ਜਾਨ ਟੈਰ ਜਿਹੜੇ ਆ ਉਹ ਵੀ ਗੱਡੀ ਦੇ ਬਿਲਕੁਲ ਠੀਕ ਹੋਣ ਰਾਹ ਦੇ ਵਿੱਚ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ ਆਪਣਾ ਸਾਨੂੰ ਸਾਰਾ ਕੁਝ ਤੁਸੀਂ ਦੱਸ ਦਿਓ ਤਾਂ ਜੋ ਅਸੀਂ ਵੀ ਵੇਲੇ ਸਿਰ ਇੱਥੋਂ ਤੁਰ ਪਈਏ ਹਰ ਹਾਲਤ 'ਚ ਵੈਸੇ 'ਤੇ ਤੁਸੀਂ ਸਵਾ ਕੁ ਨੌਂ ਵਜੇ ਤੱਕ ਹੀ ਪਹੁੰਚ ਜਾਇਓ ਠੀਕ ਆ ਭਾਅ ਜੀ ਫੋਨ ਕਰਕੇ ਮੈਨੂੰ ਦੱਸ ਦਿਓ ਕਿ ਕਿਰਾਏ ਦਾ ਤੁਹਾਡਾ ਕਿੱਦਾਂ ਕਰਨਾ